ਸਤਿ ਸ਼੍ਰੀ ਅਕਾਲ ਜੀ ਤੁਸੀਂ ਟਰੈ ਟਰੈਵਲ ਏਜੰਸੀ ਤੋਂ ਗੱਲ ਕਰ ਰਹੇ ਹਾਂ ਹਾਂਜੀ ਮੈਂ ਇੱਕ ਕੈਬ ਬੁੱਕ ਕਰਨੀ ਸੀ ਅਤੇ ਹਾਂਜੀ ਆਉਣ ਲੈ ਕੇ ਵੀ ਆਉਣਾ ਹੈ ਅਤੇ ਜਾਣਾ ਵੀ ਹੈ ਹਾਂਜੀ ਅਤੇ ਉਹਨੂੰ ਕੀ ਕਹਿੰਦੇ ਮੈਂ ਖਰੜ ਤੋਂ ਤੁਸੀਂ ਮੈਨੂੰ ਲੈ ਕੇ ਜਾਓਗੇ ਅਤੇ ਮੋਹਾਲੀ ਉਤਾਰੋਗੇ ਹਾਂਜੀ ਫਿਰ ਮੋਹਾਲੀ ਤੋਂ ਖਰੜ ਅਤੇ ਸਵੇਰੇ ਮੈ ਨੌਂ ਵਜੇ ਜਾਣਾ ਹੈ ਅਤੇ ਸ਼ਾਮੀ ਰਾ ਰਾਤ ਨੂੰ ਦਸ ਵਜੇ ਮੈਨੂੰ ਹਾਂਜੀ ਖਰੜ ਹੀ ਡਰੋਪ ਕਰਨਾ ਅਤੇ ਹਾਂਜੀ ਕੈਬ ਬਿਲਕੁਲ ਸਾਫ ਹੋਣੀ ਚਾਹੀਦੇ ਹੈ ਅਤੇ ਵਰਦੀ ਪਾਈ ਵੀ ਹੋਣੀ ਚਾਹੀਦੀ ਹੈ